ਬਰਤਨ ਧੋਣ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜੂਠ ਉਤਾਰੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਸਾਬਣ ਦੀ ਟਿੱਕੀ ਨਾਲ ਸਾਫ ਕਰਦੇ ਹਾਂ ਅਤੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ ਬਟ ਜੋ ਤੇਲ ਵਾਲੇ ਬਰਤਨ ਹੁੰਦੇ ਆ ਉਹਨਾਂ ਨੂੰ ਪਹਿਲਾਂ ਗਰਮ ਪਾਣੀ ਦੇ ਵਿੱਚ ਧੋਇਆ ਜਾਂਦਾ ਹੈ ਕਿਉਂਕਿ ਵੈਸੇ ਹੀ ਉਹਨਾਂ ਦੀ ਜੋ ਚਿਕਨਾਈ ਹੁੰਦੀ ਹੈ ਜਾਂ ਫਿਰ ਜਾਂ ਕੋਈ ਬਰਤਨ ਜੈਸੇ ਅ ਤੇਲ ਨਾਲ ਜਲਿਆ ਹੁੰਦਾ ਅਤੇ ਉਹ ਬਿਨਾਂ ਗਰਮ ਪਾਣੀ ਕੀਤੇ ਹੋਏ ਆਸਾਨੀ ਨਾਲ ਨਹੀਂ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਪਹਿਲਾਂ ਅਸੀਂ ਗਰਮ ਪਾਣੀ ਦੇ ਵਿੱਚੋਂ ਉਹਨਾਂ ਨੂੰ ਦੋ ਤਿੰਨ ਵਾਰੀ ਹੰਗਾਲਦੇ ਹਾਂ ਚੰਗੀ ਤਰ੍ਹਾਂ ਧੋ ਕੇ ਫਿਰ ਸਾਬਣ ਨਾਲ ਧੋ ਕੇ ਅਤੇ ਫਿਰ ਪਾਣੀ ਨਾਲ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ ਵੈਸੇ ਤਾਂ ਅੱਜ ਕੱਲ੍ਹ ਹੁਣ ਜੋ ਦੇਖਿਆ ਜਾਂਦਾ ਹੈ ਕਿ ਬਰਤਨ ਧੋਣ ਵਾਲੀ ਮਸ਼ੀਨ ਵੀ ਆ ਗਈ ਹੈ ਜਿਹਦੇ ਵਿੱਚ ਬਰਤਨ ਕਾਫੀ ਵਧੀਆ ਤਰੀਕੇ ਨਾਲ ਚਮਕਦੇ ਹੋਏ ਸਾਫ਼ ਹੋ ਜਾਂਦੇ ਹਨ ਬਟ ਉਸ ਦਾ ਇੱਕ ਡਰੋਬੈਕ ਵੀ ਹੈ ਕਿ ਉਸ ਦੇ ਵਿੱਚ ਜੋ ਬਰਤਨ ਨੇ ਉਹ ਟੁੱਟ ਜਾਂਦੇ ਨੇ ਇਸ ਲਈ ਥੋੜ੍ਹਾ ਉਸ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਬਰਤਨ ਖ਼ਰਾਬ ਹੋ ਜਾਂਦੇ ਆ ਟੁੱਟ ਜਾਂਦੇ ਆ ਵੈਸੇ ਉਸ ਵਿੱਚ ਸਫਾਈ ਵੀ ਜੋ ਬਰਤਨਾਂ ਦੀ ਹੈ ਉਹ ਬਹੁਤ ਅੱਛੀ ਹੁੰਦੀ ਹੈ ਥੈਂਕ ਯੂ